ਇੱਥੇ ਬਹੁਤ ਜ਼ਿਆਦਾ ਸਿਆਸੀ ਸਮੂਹ ਸੰਗਠਨ ਹਨ ਜੋ ਟੂਰਨਾਮੈਂਟ ਦਾ ਬਹੁਤ ਪ ਬਹੁਤ ਵਧੀਆ ਪ੍ਰਬੰਧ ਕਰਦੇ ਹਨ ਜਿਵੇਂ ਕਿ ਲੋਯਨ ਕਲੱਬ ਐੱਸ ਜੀ ਪੀ ਸੀ ਦੇ ਬਹੁਤ ਸਾਰੇ ਕਲੱਬ ਹਨ ਜੋ ਕਿ ਟੂਰਨਾਮੈਂਟ ਕਰਵਾਉਂਦੇ ਹਨ ਜਿਨ੍ਹਾਂ 'ਚ ਪਹਿਲਾ ਇਨਾਮ ਇੱਕਵੰਜਾ ਹਜ਼ਾਰ ਦੂਜਾ ਇੱਕਤਾਲੀ ਹਜ਼ਾਰ ਏਦਾਂ ਦੇ ਸਾਰੇ ਇਨਾਮ ਰੱਖਦੇ ਹਨ ਕੁਝ ਕੁ ਟੂਰਨਾਮੈਂਟ ਵਿੱਚ ਤਾਂ ਬੌਲਟ ਮੌਟਰਸਾਇਕਲ ਜਾਂ ਗੱਡੀਆਂ ਵੀ ਉਪਲਬਧ ਕਰਵਾਉਂਦੇ ਹਨ ਅਤੇ ਉਹ ਸਾਰੇ ਜਿੱਦਾਂ ਕਿ ਜੋ ਖਿਡਾਰੀ ਖੇਡਣ ਆਉਂਦੇ ਉਹਨਾਂ ਲਈ ਲੰਗਰ ਜਾਂ ਖਾਣ ਪੀਣ ਦਾ ਹੋੋਰ ਨਾ ਕੁਛ ਨਾ ਕੁਛ ਪ੍ਰਬੰਧ ਕਰ ਕੀਤਾ ਜਾਂਦਾ